ਨਹੀਂ ਮੈਂ ਕੋਈ ਵੀ ਯੂਐੱਫਓਸ ਨੋਟ ਨਹੀਂ ਕੀਤਾ ਬੱਟ ਮੈਂ ਉਸਨੂੰ ਡਿਸਕਵਰੀ 'ਤੇ ਦੇਖਿਆ ਹੈਗਾ ਗਾ ਡਿਸਕਵਰੀ 'ਤੇ ਇੱਕ ਸ਼ੋਅ ਚੱਲਦਾ ਹੈਗਾ ਬਹੁਤ ਸਾਰੇ ਚੈਨਲਸ 'ਤੇ ਹੋਰ ਵੀ ਸ਼ੋਅ ਚੱਲਦੇ ਹੈਗੇ ਐਗੇ ਮੈਂ ਇੱਕ ਡਿਸਕਵਰੀ ਦੇ ਚੈਨਲ ਦੇ ਸ਼ੋਅ 'ਤੇ ਦੇਖਿਆ ਸੀਗਾ ਜਿਸ ਦੇ ਵਿੱਚ ਅਮੈਰਿਕਾ ਦੇ ਵਿੱਚ ਏਰੀਆ ਫਿਫਟੀ ਵਨ ਹੈਗਾ ਜਿਸ ਵਿੱਚ ਬਹੁਤ ਜ਼ਿਆਦਾ ਉਨ੍ਹਾਂ ਨੇ ਏਲੀਅਨਸ ਬਾਰੇ ਸਰਚ ਕੀਤੀ ਹੈ ਸਪੇਸ਼ਿਪਸ ਬਾਰੇ ਦੱਸਿਆ ਗਿਆ ਹੈਗਾ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਉਸ ਦਾ ਹੈਗਾ ਐਲ ਐਲੀਅਨ ਕਿਸ ਤਰ੍ਹਾਂ ਆ ਰਹੇ ਹੈਗੇ ਹੈ ਉਹਦੇ ਬਾਰੇ ਦੱਸਿਆ ਗਿਆ ਹੈਗਾ ਠੀਕ ਹੈ ਅਤੇ ਹੁਣ ਰਿਸਰਚ ਸੈਂਟਰਸ 'ਚ ਬਹੁਤ ਕੁਛ ਉਸ ਦੇ ਬਾਰੇ ਦੱਸ ਰਹੇ ਹੈਗੇ ਐਗੇ ਐਲੀਅਨਸ ਦੀ ਲਾਈਫ ਕਿਸ ਤਰ੍ਹਾਂ ਹੈਗੀ ਐਗੀ ਉਸ ਸਾਰਾ ਕੁਛ ਮੈਂ ਜਿਹੜਾ ਹੈਗਾ ਗਾ ਡਿਸਕਵਰੀ ਦੇ ਚੈਨਲ 'ਤੇ ਦੇਖਿਆ ਸੀਗਾ ਹੋਰ ਮੈਂ ਇੱਕ ਦੋ ਚੈਨਲਾਂ 'ਤੇ ਹੋਰ ਜਿਹੜਾ ਹੈਗਾ ਇਹਦਾ ਉਹ ਦੇਖਿਆ ਬੱਟ ਮੈਂ ਜ਼ਿਆਦਾ ਜਿਹੜਾ ਹੈਗਾ ਡੀਪਲੀ ਹੈਗਾ ਗਾ ਡਿਸਕਵਰੀ ਚੈਨਲ 'ਤੇ ਹੀ ਦੇਖਿਆ ਸੀਗਾ ਜੀਹਦੇ ਵਿੱਚ ਏਰੀਆ ਫਿਫਟੀ ਵਨ ਜਿਹੜਾ ਹੈਗਾ ਗਾ ਉਹਦੇ ਬਾਰੇ ਡੀਪਲੀ ਜਿਹੜਾ ਹੈਗਾ ਦੱਸਿਆ ਗਿਆ ਸੀਗਾ ਵੀ ਉਸ ਵਿੱਚ ਕਿਸ ਤਰ੍ਹਾਂ ਐਲੀਅਨ 'ਤੇ ਸਪੇਸ਼ਿਪਸ ਬਾਰੇ ਬਾਰੇ ਰਿਸਰਚ ਕੀਤੀ ਜਾ ਰਹੀ ਹੈਗੀ ਹੈਗੀ ਸੋ ਮੈਨੂੰ ਉਹ ਉਂਝ ਮੈਂ ਕੁਛ ਨਹੀਂ ਦੇਖਿਆ ਬੱਟ ਮੈਂ ਡਿਸਕਵਰੀ 'ਤੇ ਹੀ ਦੇਖਿਆ ਸੀਗਾ